ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ ਵੈਸੇ ਤਾਂ ਆਪਣੇ ਬਹੁਤ ਸਾਰੇ ਵੇਖਿਓ ਕਿ ਪ੍ਰਸਿੱਧ ਜਿਹੜੇ ਗਾਇਕ ਹੋਏ ਹਨ ਹੈ ਨਾ ਜਿੱਦਾਂ ਕਿ ਉਹਨਾਂ ਵਿੱਚ ਆਉਂਦੇ ਹਨ ਤੁਸੀਂ ਵੀ ਕਈ ਵਾਰੀ ਬਹੁਤ ਵਾਰੀ ਸੁਣਿਆ ਹੋਏਗਾ ਜਿੱਦਾਂ ਫੇਮਸ ਬੜੇ ਨੇ ਦਿਲਜੀਤ ਦੁਸਾਂਝ ਨੇ ਹੈ ਨਾ ਗੁਰਦਾਸ ਮਾਨ ਜਿਹੜੇ ਪੁਰਾਣੇ ਸਿੰਗਰ ਸੀਗੇ ਹੈ ਨਾ ਨਿਮਰਤ ਖਹਿਰਾ ਜੇ ਫੀਮੇਲ ਸਿੰਗਰ ਦੀ ਤੁਸੀਂ ਗੱਲ ਲੈ ਲਉ ਅਤੇ ਨਿਮਰਤ ਖਹਿਰਾ ਸੀਗੇ ਹੈ ਨਾ ਸਤਿੰਦਰ ਸੱਤੀ ਜਿਨ੍ਹਾਂ ਨੇ ਬਹੁਤ ਸਾਰੇ ਜਿਹੜੇ ਫੋਕ ਜਿਹੜੇ ਸੌਂਗ ਹੈ ਜਿਹੜੇ ਗਾਏ ਹੈ ਹੈ ਨਾ ਅਤੇ ਬੜੇ ਹੀ ਜਿਹੜੇ ਪ੍ਰਚੱਲਿਤ ਵੀ ਹੋਏ ਆ ਹੈ ਨਾ ਜਿੱਦਾਂ ਪੁਰਾਣੇ ਪੁਰਾਣੇ ਜਿਹੜੇ ਸਿੰਗਰ ਸੀਗੇ ਉਦੋਂ ਕੀ ਗਾ ਕਿ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਨਹੀਂ ਸੀਗਾ ਅਤੇ ਉਦੋਂ ਕੀ ਸੀ ਲੋਕ ਅਖਾੜੇ ਦੇ ਵਿੱਚ ਵੀ ਜਿਹੜੇ ਆਪਣੇ ਸਿੰਗਰ ਸੀ ਗੁਰਦਾਸ ਮਾਨ ਹੋਏ ਹੈ ਨਾ ਅਤੇ ਇਹ ਜਿਹੜੇ ਸੀਗੇ ਕਿ ਅਖਾੜੇ ਦੇ ਵਿੱਚ ਗਾਉਂਦੇ ਹੁੰਦੇ ਸੀਗੇ ਅਤੇ ਲੋਕ ਵੀ ਜਿਹੜਾ ਉਹਨੂੰ ਬੜੇ ਮੰਨਦੇ ਹੁੰਦੇ ਸੀਗੇ ਹੈ ਨਾ ਅਤੇ ਕਿੰਨਾ ਮੰਨੋਰੰਜਨ ਦਾ ਇੱਕ ਬਹੁਤ ਵਧੀਆ ਸਾਧਨ ਹੁੰਦਾ ਸੀਗਾ ਹੈ ਨਾ ਅਤੇ ਬੱਬੂ ਮਾਨ ਹੁੰਦਾ ਸੀਗਾ ਹੋਰ ਵੀ ਬਹੁਤ ਸਾਰੇ ਜਿਹੜੇ ਸਿੰਗਰ ਸੀਗੇ ਦਿਲਜੀਤ ਦੋਸਾਂਝ ਹੋ ਗਿਆ ਗੈਰੀ ਸੰਧੂ ਹੋ ਗਏ ਹੈ ਨਾ ਇਹ ਸਾਰੇ ਬਹੁਤ ਵਧੀਆ ਸਿੰਗਰਸ ਨੇ ਤਾਂ ਹੁਣ ਵੇਖੋ ਦਿਲਜੀਤ ਦੋਸਾਂਝ ਆ ਜਿਹੜੇ ਉਹ ਵੀ ਵੇਖੋ ਬਾਹਰ ਜਾ ਕੇ ਵੇਖੋ ਆਪਣੀ ਜਿਹੜੀ ਕਿੰਨੀ ਜਿਹੜਾ ਮਿਊਜਿਕ ਆ ਉਹ ਦੇ ਰਹੇ ਨੇ ਵੱਖਰੀ ਤੁਸੀਂ ਕੈਸੇਟ ਉਹਨਾਂ ਦੀਆਂ ਆਉਂਦੀਆਂ ਪਈਆਂ ਨੇ ਹੈ ਨਾ ਅਤੇ ਬਹੁਤ ਵਧੀਆ ਜਿਹੜੀ ਪ੍ਰੋਗਰੈਸ ਜਿਹੜੀ ਉਹਨਾਂ ਦੀ ਹੁੰਦੀ ਪਈ ਆ ਗੁਰਦਾਸ ਮਾਨ ਜੀ ਹੁਣ ਭਾਵੇਂ ਕਿੰਨਾ ਟਾਈਮ ਹੋ ਗਿਆ ਤਾਂ ਉਹ ਅਜੇ ਵੀ ਆਪਣੇ ਜਿਹੜੇ ਗਾਣੇ ਬੋਲਦੇ ਨੇ ਉਹਨਾਂ ਦੇ ਸਟੇਜ ਸ਼ੋਅ ਹੁੰਦੇ ਆ ਹੁਣ ਵੀ ਅੱਜ ਵੀ ਲੋਕ ਉਹਨਾਂ ਨੂੰ ਸੁਣਨਾ ਬਹੁਤ ਪਸੰਦ ਕਰਦੇ ਨੇ ਹੈ ਨਾ ਅਤੇ ਜਿਹੜੇ ਹੋਰ ਵੀ ਸਿੰਗਰ ਨੇ ਰਣਜੀਤ ਬਾਵਾ ਵਰਗੇ ਹੈ ਨਾ ਇਹ ਸਾਰੇ ਜਿਹੜੇ ਆਪਣੇ ਸ਼ੋਅਜ਼ ਵਗੈਰਾ ਕਰਦੇ ਸਟੇਜ ਦੇ ਵੱਖ ਵੱਖ ਕੰਟਰੀਆਂ 'ਚ ਜਾ ਕੇ ਹੈ ਨਾ ਅਤੇ ਬਹੁਤ ਵਧੀਆ ਜਿਹੜਾ ਲੋਕਾਂ ਦਾ ਮੰਨੋਰੰਜਨ ਦਾ ਕਹਿੰਦੇ ਸਾਧਨ ਆ ਹੈ ਨਾ ਅਤੇ ਉਹ ਬਹੁਤ ਵਧੀਆ ਜਿਹੜਾ ਸਿੰਗਰ ਜਿਹੜੇ ਹੈਗੇ ਆ ਸਾਰੇ ਹਾਂਜੀ ਹੋਰ ਇਸ ਤੋਂ ਇਲਾਵਾ ਜੀ ਤੁਸੀਂ ਮੇਰੇ ਦਿਲਜੀਤ ਦੋਸਾਂਝ ਹਾਂਜੀ ਅਤੇ ਮਤਲਬ ਤੁਸੀਂ ਕੋਈ ਮਤਲਬ ਸ਼ੋਅ ਵਗੈਰਾ ਕਰਾਉਣਾ ਤੁਸੀਂ ਮਤਲਬ ਇੱਦਾਂ ਜਿੱਦਾਂ ਪੁੱਛ ਰਹੇ ਸੀਗੇ ਮੈਨੂੰ ਤੁਸੀਂ ਕੋਈ ਇਨਵਾਈਟ ਹਾਂਜੀ ਹਾਂਜੀ ਅਤੇ ਫਿਰ ਮੇਰੇ ਹਿਸਾਬ ਦੇ ਨਾਲ ਤੁਸੀਂ ਗੁਰਦਾਸ ਮਾਨ ਜੀ ਨੂੰ ਕਹਿ ਸਕਦੇ ਹੋ ਕਿਉਂਕਿ ਉਹ ਲੋਕਾਂ ਦੇ ਜਿਹੜਾ ਕਲਚਰ ਦੇ ਨਾਲ ਜੁੜੇ ਹੋਏ ਆ ਦੇਖੋ ਹੁਣ ਕਈ ਆਪਣੇ ਆਈਡਲ ਮਤਲਬ ਕਿ ਵੱਡੀ ਏਜ਼ ਦੇ ਜਿਹੜੇ ਆਪਣੇ ਹੈ ਨਾ ਬਜ਼ੁਰਗ ਨੇ ਉਹਨਾਂ ਨੂੰ ਕਿ ਪੁਰਾਣੇ ਸਿੰਗਰਾਂ ਨੂੰ ਸੁਣਨਾ ਬਹੁਤ ਵਧੀਆ ਲੱਗਦਾ ਆ ਹੈ ਨਾ ਅਤੇ ਇਸ ਲਈ ਤੁਸੀਂ ਵਧੀਆ ਰਹੇਗਾ ਕਿ ਤੁਸੀਂ ਗੁਰਦਾਸ ਮਾਨ ਜੀ ਨੂੰ ਅ ਕਹੋ ਕਿ ਉਹ ਆਪਣਾ ਸ਼ੋਅ ਜਿਹੜਾ ਵਾ ਹੈ ਨਾ ਕਿਸੇ ਦਿਨ ਪਲੈਨ ਕਰ ਲੈਣ ਜਿਸ ਤਰ੍ਹਾਂ ਹੁਣ ਤੁਹਾਡਾ ਕੋਈ ਫੰਕਸ਼ਨ 'ਤੇ ਤੁਸੀਂ ਔਰਗਨਾਈਜ਼ ਕਰਾਉਣਾ ਵਾ ਅਤੇ ਉਹ ਤੁਸੀਂ ਉਹਨਾਂ ਨਾਲ ਕੋਂਟੈਕਟ ਕਰ ਸਕਦੇ ਹੋ ਹੈ ਨਾ ਹਾਂਜੀ ਠੀਕ ਹੈ ਓਕੇ